ਖੇਡਾਂ ਵਿੱਚ ਸਫਲਤਾ ਅਤੇ ਅਸਫਲਤਾ ਨਾਲ ਕਿਵੇਂ ਨਜਿੱਠਣਾ ਹੈ ਖੇਡਾਂ ਵਿੱਚ ਸਫਲਤਾ ਸਾਨੂੰ ਜਿੱਥੇ ਖਿਡਾਰੀ ਨੂੰ ਖੁਸ਼ੀ ਦਿੰਦੀਆਂ ਹਨ ਉੱਥੇ ਹੀ ਸਫਲਤਾ ਨਾਲ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਬੰਦਾ ਅੱਜ ਜਿ ਖਿਡਾਰੀ ਜਿੱਤਿਆ ਹੈ ਕੱਲ੍ਹ ਉਹ ਹਾਰ ਵੀ ਸਕਦਾ ਹੈ ਅਤੇ ਜੋ ਖਿਡਾਰੀ ਕੱਲ੍ਹ ਹਾਰਿਆ ਹੈ ਉਹ ਜਿੱਤ ਵੀ ਸਕਦਾ ਹੈ ਇਸ ਕਰਕੇ ਸਾਨੂੰ ਅਸਫਲਤਾ ਨਾਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਸਫਲਤਾ ਤੋਂ ਸਾਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਜਿਸ ਨਾਲ ਅਸੀਂ ਅੱਗੇ ਹੋਰ ਬਿਹਤਰ ਕਰ ਸਕੀਏ ਅਸਫਲਤਾ ਸਾਨੂੰ ਇੱਕ ਤਰੀਕੇ ਨਾਲ ਮਦਦ ਵੀ ਕਰਦੀ ਹੈ ਜਿੱਥੇ ਹੀ ਸਫਲਤਾ ਨਾਲ ਸਾਡਾ ਖੇਡਾਂ ਦੇ ਵਿੱਚ ਕੋਨਫੀਡੈਂਸ ਵੱਧਦਾ ਹੈ ਆਤਮ ਵਿਸ਼ਵਾਸ ਨਾਲ ਖਿਡਾਰੀ ਭਰ ਜਾਂਦਾ ਹੈ ਉੱਥੇ ਹੀ ਸਫਲਤਾ ਆਵੇ ਤਾਂ ਸਾਡਾ ਆਤਮ ਵਿਸ਼ਵਾਸ ਡਿੱਗਣਾ ਨਹੀਂ ਚਾਹੀਦਾ ਤਾਂ ਕਿ ਸਾਨੂੰ ਹੋਰ ਬਿਹਤਰ ਕਰਨ ਲਈ ਇੱਕ ਨਿਸ਼ਚਾ ਕਰਨਾ ਚਾਹੀਦਾ ਹੈ ਸਾਨੂੰ ਉਸ ਲਈ ਹੋਰ ਜ਼ੋਰ ਲਾਉਣਾ ਚਾਹੀਦਾ ਹੈ ਆਮ ਤੌਰ 'ਤੇ ਆਪਾਂ ਦੇਖਿਆ ਜੋ ਖਿਡਾਰੀ ਅੱਜ ਬਹੁਤ ਮਸ਼ਹੂਰ ਹਨ ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਨਾਮ ਹੈ ਉਹਨਾਂ ਨੇ ਵੀ ਪਹਿਲਾਂ ਅਸਫਲਤਾ ਦਾ ਸਾਹਮਣਾ ਕੀਤਾ ਹੈ ਅਤੇ ਅਸਫਲਤਾ ਤੋਂ ਹੀ ਸਿੱਖ ਕੇ ਉਹਨਾਂ ਨੇ ਆਪਣਾ ਉਹ ਗਲਤੀਆਂ ਤੋਂ ਬਾਰ ਬਾਰ ਸਿੱਖ ਕੇ ਅੱਗੇ ਆਪਣਾ ਦੁਨੀਆਂ ਦੇ ਵਿੱਚ ਨਾਮ ਬਣਾਇਆ ਹੈ ਜਿਸ ਤਰ੍ਹਾਂ ਖਿਡਾਰੀ ਜਿਸ ਤਰ੍ਹਾਂ ਇਨਸਾਨ ਗਲਤੀਆਂ ਦਾ ਪੁਤਲਾ ਹੈ ਉਸ ਤਰ੍ਹਾਂ ਹੀ ਖਿਡਾਰੀ ਵੀ ਬਾਰ ਬਾਰ ਅਸਫਲਤਾ ਪ੍ਰਾਪਤ ਕਰਕੇ ਆਖਿਰ ਨੂੰ ਸਫਲਤਾ ਦੇ ਵਿੱਚ ਨੂੰ ਪ੍ਰਾਪਤ ਕਰਦਾ ਹੈ ਬਿਹਤਰ ਕਰਨ ਵਿੱਚ ਅਸਫਲਤਾ ਸਾਡੀ ਮਦਦ ਵੀ ਕਰਦੀਆਂ ਹਨ ਅਸੀਂ ਇੱਕ ਗਲਤੀ ਤੋਂ ਜਿਸ ਤਰ੍ਹਾਂ ਸਿੱਖਦੇ ਹਾਂ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਗਰਾਊਂਡ ਦੇ ਵਿੱਚ ਹੋਈਆਂ ਗਲਤੀਆਂ ਤੋਂ ਵੀ ਅਸੀਂ ਸਿੱਖਦੇ ਹਾਂ ਆਪਾਂ ਨੇ ਜੋ ਖਿਡਾਰੀ ਅਕਸਰ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਅਸਫਲਤਾ ਤੋਂ ਨਿਰਾਸ਼ ਹੋ ਕੇ ਕਈ ਗਲਤ ਕਦਮ ਚੁੱਕ ਲੈਂਦੇ ਹਨ ਕਈ ਖੇਡ ਨੂੰ ਖੇਡਣਾ ਛੱਡ ਜਾਂਦੇ ਹਨ ਅਤੇ ਕਈ ਖਿਡਾਰੀ ਨਸ਼ਿਆਂ ਦੇ ਵਿੱਚ ਲੁਪਤ ਹੋ ਜਾਂਦੇ ਹਨ ਅਤੇ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਖਿਡਾਰੀ ਆਪਣਾ ਜ਼ਿੰਦਗੀ ਨੂੰ ਹੀ ਅਲਵਿਦਾ ਕਹਿ ਜਾਂਦੇ ਹਨ ਸਾਨੂੰ ਅਸਫਲਤਾ ਤੋਂ ਵੀ ਬਹੁਤ ਕੁਛ ਸਿੱਖਣ ਦੀ ਲੋੜ ਹੈ ਸਫਲਤਾ ਹਰ ਇੱਕ ਨੂੰ ਨਹੀਂ ਮਿਲਦੀ ਸਫਲਤਾ ਪਾਉਣ ਲਈ ਇੱਕ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ ਅੱਜ ਜਿੰਨੇ ਵੀ ਸਫਲ ਖਿਡਾਰੀ ਨੇ ਉਹਨਾਂ ਨੇ ਨਾ ਜਾਣੇ ਕਿੰਨੀਆਂ ਸਫਲਤਾਂ ਦਾ ਸਾ ਅਸਫਲਤਾ ਦਾ ਸਾਹਮਣਾ ਕਰਕੇ ਸਫਲਤਾ ਨੂੰ ਪ੍ਰਾਪਤ ਕੀਤਾ ਹੈ